ਹਾਂਜੀ ਅਮਨ ਅਮਨ ਬੋਲ ਰਿਹਾ ਸਿਗਾ ਜੀ ਮੈਂ ਤੁਹਾਨੂੰ ਇਹ ਪੁੱਛਣਾ ਸੀ ਆਪਣੇ ਬੱਚੇ ਕਿਹੜੇ ਸਕੂਲ 'ਚ ਪੜ ਰਹੇ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਆਪਣਾ ਬੇਟਾ ਛੋਟਾ ਜੀ ਮਤਲਬ ਸਕੂਲ ਲਾਉਣਾ ਸੀਗਾ ਜੀ

ਹਾਂਜੀ ਪਹਿਲਾਂ ਆਪਣੇ ਛੋਟੇ ਜਿਹੜੇ ਆਪਣੇ ਨੋਰਮਲ ਸਕੂਲ ਹੁੰਦੇ ਨੇ ਪਿੰਡਾਂ ਵਿੱਚ ਉਹਨਾਂ 'ਚ ਬਹਿੰਦਾ ਸੀਗਾ ਪ ਪਲੇ ਵੇ 'ਚ ਹਾਂਜੀ ਹਾਂਜੀ ਉਹਨਾਂ 'ਚੋਂ ਆਪਾਂ ਇਹ ਦੇਖਦੇ ਸੀ ਵੀ ਵੀ ਆਪਣੇ ਕਿਹੜਾ ਸਕੂਲ ਵਧੀਆ ਹੈਗਾ ਬੱਚੇ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਇੰਗਲਿਸ਼ ਮੀਡੀਅਮ ਵਧੀਆ ਮਿਲ ਗਿਆ ਕੁਛ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਸਰ ਸਰ ਸਟਾਫ ਕੀ ਏ ਇੱਥੇ ਸਪੋਰਟਸ ਵਗੈਰਾ ਬੱਚਿਆਂ ਵਾਸਤੇ ਕਿਉਂ ਆਉਣ ਵਾਲੇ ਆਉਣ ਵਾਲੇ ਟਾਈਮ 'ਚ ਬੱਚਿਆਂ ਨੂੰ ਸਪੋਰਟਸ ਜ਼ਰੂਰੀ ਅੱਜ ਕੱਲ੍ਹ ਹਾਂਜੀ ਠੀਕ ਹੈ ਜੀ ਹਾਂਜੀ ਆਪਣੇ ਆਪਣੇ ਗੁਆਂਢੀਆਂ ਦਾ ਬੇਟਾ ਪੜ੍ਹਦਾ ਸੀ ਸਕੂਲ ਦੇ ਵਿੱਚ ਉਹ ਤਾਂ ਦੱਸਦਾ ਸੀਗਾ ਜੀ ਫੁਟਬਾਲ ਖੇਡਣ ਦੇ ਵਿੱਚ ਆਪਣਾ ਦਿਲਚਸਪੀ ਉਹ ਸਕੂਲ ਦੇ ਵਿੱਚ ਇਕੱਲੇ ਬਾਸਕਿਟਬਾਲ ਇਕੱਲੇ ਬਾਸਕਿਟਬਾਲ ਕਰਾਉਂਦੇ ਸੀਗੇ ਉਹ ਘਰ ਦੇ ਤੌਰ 'ਤੇ ਕਰ ਰਹੇ ਨੇ ਉਹਨਾਂ ਤੋਂ ਵੀ ਫੁਟਬਾਲ ਖੇਡ ਉਹ ਕਹੇ ਮੈਂ ਫੁਟਬਾਲ ਖੇਡਣੀ ਆ ਜਿਹੜੇ ਸਕੂਲ ਫੁੱਟਬਾਲ ਦਾ ਗਰਾਉਂਡ ਸੀਗਾ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਟੀਚਰ ਵਗੈਰਾ ਦੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ

ਠੀਕ ਹੈ ਜੀ ਠੀਕ ਹੈ ਸਰ ਫਿਰ ਮੈਂ ਘਰ ਰਾਏ ਕਰਕੇ ਠੀਕ ਹੈ ਜੀ ਠੀਕ ਠੀਕ ਹੈ ਜੀ ਫਿਰ ਉਹ ਤਾਂ ਠੀਕ ਏ ਫਿਰ ਮੈਂ ਘਰ ਜਾ ਕੇ ਕਰਦਾ ਠੀਕ ਹੈ ਜੀ

ਠੀਕ ਹੈ ਜੀ ਠੀਕ ਹੈ ਜੀ